ਹਾਂਜੀ ਮੈਂ ਕਿਸੇ ਦੇਸ਼ ਵਿੱਚ ਤਾਂ ਨਹੀਂ ਗਈ ਮੈਂ ਕਿਸੇ ਸਥਾਨ ਵਿੱਚ ਜ਼ਰੂਰ ਗਈ ਹਾਂ ਜੋ ਕਿ ਜੋ ਕਿ ਮੇਰੇ ਜੀਵਨ ਸਥਾਨ ਤੋਂ ਦੂਰ ਹੈ ਵੈਸੇ ਤਾਂ ਪੰਛੀ ਅਲਗ ਅਲਗ ਤਰ੍ਹਾਂ ਦੇ ਹੀ ਹੁੰਦੇ ਆ ਮੈਂ ਜੂਹ ਵਿੱਚ ਗਈ ਸੀ ਅਤੇ ਉਹਦੇ ਵਿੱਚ ਕਾਫੀ ਤਰ੍ਹਾਂ ਦੇ ਪੰਛੀ ਪੰਛੀ ਸਨ ਜਿਨ੍ਹਾਂ ਦੇ ਰੰਗ ਰੂਪ ਸਭ ਬਦ ਚੇਂਜ ਸੀ ਕੋਈ ਵੀ ਇੱਕ ਤਰ੍ਹਾਂ ਦਾ ਪੰਛੀ ਨਹੀਂ ਸੀ ਹੋਰ ਤਾਂ ਹੋਰ ਉਸ ਪੰਛੀਆਂ ਦੇ ਉਸ ਪੰਛੀਆਂ ਦੇ ਉਸ ਹੋਰ ਤਾਂ ਹੋਰ ਉਸ ਪੰਛੀਆਂ ਪੰਛੀਆਂ ਦੇ ਰੰਗ ਮੂੰਹ ਬੋਲਣ ਦਾ ਬੋਲ ਚੈ ਚਹਿਕਨ ਦਾ ਤਰੀਕਾ ਵੀ ਚੇਂਜ ਸੀ ਹਰੇਕ ਹਰੇਕ ਹਰੇਕ ਅਲੱਗ ਅਲੱਗ ਅਲੱਗ ਅਲੱਗ ਪੰਛੀਆਂ ਦੇ ਅਲੱਗ ਅਲੱਗ ਬੋਲਣ ਦਾ ਤਰੀਕਾ ਸੀ ਉਹਦੇ ਵਿੱਚ ਪੰਛੀਆਂ ਦੇ ਵਿੱਚ ਤੋਤਾ ਮੈਨਾ ਬਹੁਤ ਸਾਰੇ ਹੋਰ ਪੰਛੀ ਵੀ ਸੀ ਜੋ ਬਹੁਤ ਹੀ ਆਕਰਸ਼ਿਤ ਕਰਦੇ ਸੀ ਉਹਨਾਂ ਦੀ ਆਵਾਜ਼ ਬਹੁਤ ਮਿੱਠੀ ਸੀ